ਦੇਖਣ ਲਈ ਮੇਰੀਆਂ ਕਾਫੀ ਮਨਪਸੰਦ ਥਾਂਵਾ ਹਨ ਜਿਵੇਂ ਕਿ ਰੋਕ ਗਾਰਡਨ ਜੋ ਚੰਡੀਗੜ੍ਹ ਵਿੱਚ ਹੈ ਇਹ ਰੋਕ ਗਾਰਡਨ ਨੇਕ ਚੰਦ ਦੁਆਰਾ ਬਣਾਇਆ ਗਿਆ ਹੈ ਉਹਨਾਂ ਨੇ ਵੇਸਟ ਮਟੀਰੀਅਰ ਜਿਵੇਂ ਕਿ ਟੂਟੀਆਂ ਚੂੜੀਆਂ ਅਤੇ ਸਿਰਾਮਿਕ ਟਾਈਲਾਂ ਨਾਲ ਅਣਗਿਣਤ ਮੂਰਤੀਆਂ ਬਣਾਈਆਂ ਹੋਈਆਂ ਹਨ ਸੁਖਨਾ ਲੇਕ 'ਤੇ ਵੀ ਜਾਣਾ ਮੈਨੂੰ ਬਹੁਤ ਪਸੰਦ ਹੈ ਉੱਥੇ ਵੋਟਿੰਗ ਕਰਨਾ ਕੰਢੇ 'ਤੇ ਬਹਿਣਾ ਚੰਗਾ ਲੱਗਦਾ ਹੈ ਮੇਰੇ ਬੱਚੇ ਚਿੜੀਆ ਘਰ ਨੂੰ ਵੀ ਕਾਫੀ ਪਸੰਦ ਕਰਦੇ ਨੇ ਉੱਥੇ ਉਹ ਵੱਖ ਵੱਖ ਪੰਛੀਆਂ ਨੂੰ ਦੇਖ ਕੇ ਬੜੇ ਖੁਸ਼ ਹੁੰਦੇ ਹਨ ਚੰਡੀਗੜ੍ਹ ਵਿੱਚ ਅਸੀਂ ਰੋਜ਼ ਗਾਰਡਨ ਵੀ ਜਾਂਦੇ ਹਾਂ ਪਿੰਕ ਸਿਟੀ ਜੈਪੁਰ 'ਚ ਬਹੁਤ ਸਾਰੀਆਂ ਥਾਵਾਂ ਹਨ ਜਿਵੇਂ ਕਿ ਜਲ ਮਹਿਲ ਹਵਾ ਮਹਿਲ ਜੰਤਰ ਮੰਤਰ ਵਿਰਲਾ ਮੰਦਰ ਰਾਜ ਮੰਦਰ ਡਲ ਝੀਲ 'ਤੇ ਵੀ ਜੋ ਕਿ ਕਸ਼ਮੀਰ ਵਿੱਚ ਹੈ ਉਹ ਵੀ ਬੜੀ ਚੰਗੀ ਲੱਗਦੀ ਹੈ ਗੁਲਮਰਗ ਜੋ ਕਿ ਬਰਫ ਨਾਲ ਢੱਕਿਆ ਹੁੰਦਾ ਹੈ ਉੱਥੇ ਸਕੇਟਿੰਗ ਕਰਨਾ ਬੜਾ ਚੰਗਾ ਲੱਗਦਾ ਹੈ